ਭੰਗੜਾ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਉਂਦਾ ਹੈ ਅਤੇ ਜਦੋਂ ਕਿ ਭੰਗੜੇ ਦਾ ਪ੍ਰਯੋਗ ਜਸ਼ਨ ਦੇ ਵਿੱਚ ਕੀਤਾ ਜਾਵੇ ਕਿਸੇ ਵੀ ਜਸ਼ਨ ਦੇ ਵਿੱਚ ਕੀਤਾ ਜਾਵੇ ਤਾਂ ਖੁਸ਼ੀ ਲੋਕਾਂ ਦੀ ਚੌਗੁਣੀ ਹੋ ਜਾਂਦੀ ਹੈ ਭੰਗੜਾ ਵੇਖਦੇ ਹੀ ਲੋਕਾਂ ਦੇ ਅੰਦਰ ਉਤਸ਼ਾਹ ਪੈਦਾ ਹੋ ਜਾਂਦਾ ਹੈ ਅਤੇ ਉਹਨਾਂ ਦਾ ਵੀ ਨੱਚਣ ਟੱਪਣ ਨੂੰ ਜੀਅ ਕਰਨ ਲੱਗ ਜਾਂਦਾ ਹੈ ਭੰਗੜੇ ਤੋਂ ਪੰਜਾਬ ਦਾ ਸੱਭਿਆਚਾਰ ਵੀ ਪਤਾ ਲੱਗਦਾ ਹੈ ਜਦੋਂ ਵੀ ਕਿਤੇ ਵੀ ਪੰਜਾਬ ਦਾ ਕੋਈ ਸੱਭਿਆਚਾਰ ਦਿਖਾਉਣਾ ਹੋਵੇ ਤਾਂ ਉੱਥੇ ਭੰਗੜਾ ਤਾਂ ਕੀਤਾ ਹੀ ਜਾਂਦਾ ਹੈ ਅਤੇ ਬੁੱਢੀਆਂ ਦੁਆਰਾ ਗਿੱਧਾ ਕੀਤਾ ਜਾਂਦਾ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਵਿੱਚ ਭੰਗੜਾ ਬਹੁਤ ਹੀ ਵੱਡਾ ਯੋਗਦਾਨ ਪਾਉਂਦਾ ਹੈ ਅਤੇ ਨਾਲ ਹੀ ਨਾਲ ਜਸ਼ਨ ਵਿੱਚ ਵੀ ਇਹਦਾ ਬਹੁਤ ਹੀ ਵੱਡਾ ਹੱਥ ਹੁੰਦਾ ਹੈ